ਹਰ ਰੋਜ਼ ਪਰਮਾਤਮਾ ਦਾ ਨਾਮ ਜਪਣਾ ਹੀ ਮੇਰੀ ਸਭ ਤੋਂ ਵੱਡੀ ਸ਼ਕਤੀ ਹੈ ਅਤੇ ਮੈਂ ਧਾਰਮਿਕ ਕੰਮਾਂ ਵਿੱਚ ਵੀ ਅੱਗੇ ਹੋ ਕੇ ਵੱਧ ਤੋਂ ਵੱਧ ਹਿੱਸਾ ਪਾਉਂਦੀ ਹਾਂ ਅਤੇ ਮੇਰੇ ਵਿੱਚ ਇੱਕ ਖੂਬੀ ਇਹ ਵੀ ਹੈ ਕਿ ਮੈਂ ਇੱਕੋ ਸਮੇਂ ਕਈ ਤਰ੍ਹਾਂ ਦੇ ਕੰਮ ਸਾਂਭ ਲੈਂਦੀ ਹਾਂ ਅਤੇ ਮੈਂ ਆਪਣੇ ਮਨ ਦੀ ਬੌਸ ਮੈਂ ਆਪ ਹਾਂ ਅਤੇ ਮੈਂ ਆਪਣੇ ਮਨ ਦੇ ਹਿਸਾਬ ਦੇ ਨਾਲ ਹੀ ਕੰਮ ਕਰਦੀ ਹਾਂ ਅਤੇ ਮੈਂ ਹਰੇਕ ਕੰਮ ਪੂਰੇ ਧਿਆਨ ਨਾਲ ਕਰਦੀ ਹਾਂ ਅਤੇ ਆਪਣਾ ਰੂਟੀਨ ਵਰਕ ਵੀ ਪੂਰੇ ਸਮੇਂ 'ਤੇ ਮੈਂ ਪੂਰਾ ਕਰ ਲੈਂਦੀ ਹਾਂ ਅਤੇ ਪਰ ਮੇਰੀ ਸਭ ਤੋਂ ਵੱਡੀ ਕਮਜ਼ੋਰੀ ਇਹ ਹੈ ਕਿ ਮੈਂ ਕੋਈ ਵੱਡਾ ਡਸੀਜ਼ਨ ਨਹੀਂ ਲੈ ਸਕਦੀ ਉਸਦੇ ਵਿੱਚ ਮੈਂ ਥੋੜ੍ਹਾ ਕਨਫਿਊਜ਼ ਹੋ ਜਾਂਦੀ ਹਾਂ ਅਤੇ ਇਸ ਤੋਂ ਇਲਾਵਾ ਮੇਰੀ ਇੱਕ ਕਮਜ਼ੋਰੀ ਇਹ ਹੈ ਕਿ ਸਰਦੀਆਂ ਦੇ ਵਿੱਚ ਮੈਨੂੰ ਕੰਮ ਕਰਨ ਦੀ ਬੜੀ ਦਿੱਕਤ ਆਉਂਦੀ ਹੈ ਕਿਉਂਕਿ ਉਦੋਂ ਮੇਰੀ ਸਿਹਤ ਠੀਕ ਨਹੀਂ ਰਹਿੰਦੀ ਜ਼ਿਆਦਾਤਰ ਮੈਨੂੰ ਕੰਮ ਕਰਨ ਵਿੱਚ ਦਿੱਕਤ ਆਉਂਦੀ ਹੈ